ਹਾਂਜੀ ਮੇਰੀ ਹਰ ਸਮੇਂ ਦੀ ਮਨ ਪਸੰਦ ਪਕਵਾਨ ਬਾਰੇ ਤੁਸੀਂ ਗੱਲ ਕਰ ਰਹੇ ਹੋ ਤਾਂ ਵੈਸੇ ਤਾਂ ਮੈਂ ਸਾਰੇ ਪਕਵਾਨ ਹੀ ਜਿਹੜੇ ਵੀ ਬਣਾ ਵੀ ਲੈਂਦੀ ਖੁਦ ਔਰ ਮੈਂ ਬਣਾ ਵੀ ਲੈਂਦੀ ਹਾਂ ਪਰ ਮੈਨੂੰ ਜੋ ਖਾਣੇ ਦੀ ਗੱਲ ਕਰੀਏ ਤਾਂ ਵੈਸੇ ਤਾਂ ਮੈਨੂੰ ਸਭ ਹੀ ਵਧੀਆ ਲੱਗਦਾ ਹੈਗਾ ਵੀ ਜਿੱਦਾਂ ਦੇ ਵੀ ਖਾਣੇ ਹੁੰਦੇ ਨੇ ਪਰ ਮੈਨੂੰ ਸਭ ਤੋਂ ਬੈਸਟ ਲੱਗਦਾ ਹੈਗਾ ਪੰਜਾਬੀ ਦਾਲ ਰੋਟੀ ਖਾਣਾ ਠੀਕ ਹੈ ਮਟਕ ਪਨੀਰ ਦੀ ਸਬਜ਼ੀ ਹੋਵੇ ਔਰ ਨਾਲ ਛੋਲੇ ਠੀਕ ਹੈ ਤਾਂ ਬਹੁਤ ਜ਼ਿਆਦਾ ਪਸੰਦ ਨੇ ਮੈਨੂੰ ਇਹ ਚੀਜ਼ਾਂ ਤਾਂ ਜਿਹੜਾ ਕਿ ਮੇਰਾ ਬਾਰ ਬਾਰ ਬਾਰ ਬਾਰ ਮੈਨੂੰ ਇਸਤੋਂ ਜਿਹੜਾ ਕਿ ਬਣਾਉਣ ਦਾ ਵੀ ਮਨ ਕਰਦਾ ਔਰ ਖੁਦ ਦਾ ਵੀ ਖਾਣ ਨੂੰ ਜੀ ਕਰਦਾ ਔਰ ਮੈਂ ਆਪਣੇ ਘਰਦਿਆਂ ਨੂੰ ਵੀ ਬਣਾ ਕੇ ਦੇਵਾਂ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਇਹ ਚੀਜ਼ਾਂ ਠੀਕ ਆ ਜਿੱਦਾਂ ਪੰਜਾਬੀ ਦਾਲ ਰੋਟੀ ਹੋ ਗਈ ਛੋਲੇ ਕੁਲਚੇ ਹੋ ਗਏ ਮਟਰ ਪਨੀਰ ਹੋ ਗਿਆ ਤਾਂ ਇਹ ਸਭ ਤੋਂ ਜ਼ਿਆਦਾ ਮੈਨੂੰ ਬੈਸਟ ਲੱਗਦੇ ਹੈਗੇ ਆ

ਇਸ ਕਰਕੇ ਮੈਨੂੰ ਬਸ ਖਾਸ ਤੌਰ 'ਤੇ ਮੈਨੂੰ ਪੰਜਾਬੀ ਦਾਲ ਰੋਟੀ ਵਧੀਆ ਲੱਗਦੀ ਹੈ ਇਹ ਮੇਰੀ ਮਨਪਸੰਦ ਦੀ ਸਭ ਤੋਂ ਬੈਸਟ ਮੇਰੀ ਹੈਗੀ ਆ ਮਟਰ ਪਨੀਰ ਦੀ ਦਾਲ ਔਰ ਨਾਲ ਰੋਟੀ ਸਭ ਤੋਂ ਬੈਸਟ ਲੱਗਦੀ ਆ ਮੈਨੂੰ ਤਾਂ ਜਿਹੜੀ ਮੈਂ ਬਾਰ ਬਾਰ ਟਰਾਈ ਕਰਦੀ ਹਾਂ ਘਰ ਜਿਹੜੀ ਮੈਂ ਹਰ ਵਾਰ ਮੇਰਾ ਮਨ ਨਹੀਂ ਭਰਦਾ ਹੈਗਾ ਇਹਨਾਂ ਚੀਜ਼ਾਂ ਤੋਂ ਮੈਨੂੰ ਬਹੁਤ ਬੈਸਟ ਲੱਗਦੀ ਆ